ਮੈਂ ਬਰਿੰਦਰ ਸਿੰਘ ਫਤਿਹਗੜ੍ਹ ਸਾਹਿਬ ਜਿਲ੍ਹੇ ਬਾਰੇ ਜਿਹੜੇ ਇੱਥੇ ਸੈਲਾਨੀਆਂ ਦੇ ਆਕਰਸ਼ਨ ਸਥਾਨ ਨੇ ਉਹਨਾਂ ਬਾਰੇ ਦੱਸਣਾ ਚਾਹੁੰਦਾ ਜਿਸ ਵਿੱਚ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਮੰਨੀ ਜਾਂਦੀ ਐ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਰ ਵੀ ਬਹੁਤ ਸ਼ਹੀਦੀਆਂ ਪ੍ਰਾਪਤ ਹੋਈਆਂ ਇੱਥੇ ਸ਼ਹੀਦਾਂ ਦੀ ਧਰਤੀ ਮੰਨੀ ਗਈ ਆ ਮੇਨ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਟੋਡਰ ਮੱਲ ਜੀ ਦੀ ਹਵੇਲੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਜਗ੍ਹਾ ਮੁੱਲ ਲਈ ਸੀ ਅਤੇ ਹੋਰ ਇੱਥੇ ਆਮ ਖਾਸ ਬਾਗ ਹੈ ਬਣਿਆ ਹੋਇਆ ਅਤੇ ਹੋਰ ਵੀ ਬਹੁਤ ਸਥਾਨ ਨੇ ਜਿਹੜੇ ਦੂਰੋਂ ਦੂਰੋਂ ਸੈਲਾਨੀ ਸੰਗਤਾਂ ਦੇ ਰੂਪ ਵਿੱਚ ਆਉਂਦੇ ਨੇ